ਪੰਜਾਬ ਵਿੱਚ ਸਾਡੀ ਸਰਕਾਰ ਨੇ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਜਿਵੇਂ ਕਿ ਸਿੱਖਿਆ ਪ੍ਰਤੀ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਅਤੇ ਬ ਬਹੁਤ ਹੀ ਜ਼ਿਆਦਾ ਧਿਆਨ ਦਿੱਤਾ ਸਿੱਖਿਆ ਲਈ ਜਿਵੇਂ ਕਿ ਪਹਿਲਾਂ ਦੇ ਜ਼ਮਾਨੇ ਵਿੱਚ ਕੀ ਹੁੰਦਾ ਸੀ ਲੋਕ ਅਨਪੜ੍ਹ ਹੁੰਦੇ ਸੀਗੇ ਲੋਕਾਂ ਨੂੰ ਕੁਛ ਨਹੀਂ ਪਤਾ ਹੁੰਦਾ ਸੀਗਾ ਕਿਵੇ ਖੇਤੀਬਾੜੀ ਸਾਰਾ ਕੁਛ ਚੱਲਦਾ ਪਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਸਰਕਾਰ ਨੇ ਮਤਲਬ ਸਭ ਲਈ ਪੜ੍ਹਾਈ ਦਾ ਮਤਲਬ ਉਹ ਕਰਤਾ ਮਤਲਬ ਜਵਾਕਾਂ ਨੂੰ ਜਦੋਂ ਜ਼ਿਆਦਾ ਪੜ੍ਹਦੇ ਹਨ ਜ਼ਿਆਦਾ ਹੈ ਨਾ ਨੰਬਰ ਲਿਆਉਂਦੇ ਹਨ ਉਹਨਾਂ ਨੂੰ ਸਕਾਲਰਸ਼ਿਪਸ ਮਿਲਦੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਜਿਹਦੇ ਕਰਕੇ ਬਹੁਤ ਸਾਰੇ ਪੈਸੇ ਵੀ ਮਿਲਦੇ ਹਨ ਟੀਚਰਾਂ ਦੀ ਨੌ ਨੌਕਰੀ ਹੁਣ ਮਤਲਬ ਪਹਿਲਾਂ ਦੇ ਜ਼ਮਾਨੇ 'ਚ ਕੀ ਹੁੰਦਾ ਸੀ ਲੋਕਾਂ ਨੂੰ ਕੁਛ ਨਹੀਂ ਪਤਾ ਹੁੰਦਾ ਸੀਗਾ ਲੋਕਾਂ ਨੂੰ ਉਹ ਤੋਲ ਤੂਲ ਕਿਵੇਂ ਕਰਦੇ ਆ ਸਭ ਕੁਛ ਪਰ ਹੁਣ ਦੇ ਜ਼ਮਾਨੇ ਵਿੱਚ ਜਿਹੜੇ ਸਰਕਾਰ ਨੇ ਕਾਫੀ ਜ਼ਿਆਦਾ ਸਕੀਮਾਂ ਬਣਾਈਆਂ ਹਨ ਐਸ ਸੀ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਮਤਲਬ ਫਰੀ ਕਿਤੇ ਵੀ ਪੜ੍ਹਾਈ ਕਰਨ ਨੂੰ ਮਿਲਦੀ ਹੈ ਜੇ ਜਿਵੇਂ ਵੀ ਉਹ ਜਾ ਵੜਨ ਕਾਲਜਾਂ 'ਚ ਜਾ ਵੜਨ ਸਕੂਲਾਂ 'ਚ ਜਾ ਵੜਨ ਉਹਨਾਂ ਨੂੰ ਹਰੇਕ ਕੋਰਸ ਫਰੀ 'ਚ ਕਰਵਾਇਆ ਜਾਂਦਾ ਜਿਹੜੀ ਕੰਪਿਊਟਰ ਕੋਚਿੰਗ ਹੈ ਉਹ ਸਰਕਾਰ ਨੇ ਫਰੀ ਕਰ ਦਿੱਤੀਆਂ ਉਹਨਾਂ ਨੂੰ ਫਰੀ 'ਚ ਸਿਖਾਈ ਜਾਂਦੀ ਹੈ ਕਾਫੀ ਇਹੋ ਜਿਹੇ ਸਕੂਲ ਨੇ ਜਿਹੜੇ ਗਰੀਬਾਂ ਬੱਚਿਆਂ ਲਈ ਹੈ ਨਾ ਘੱਟ ਉਹ ਰੱਖਦੇ ਨੇ ਘੱਟ ਫੀਸ ਰੱਖਦੇ ਨੇ ਅਤੇ ਉਹਨਾਂ ਨੂੰ ਉਹਨਾਂ ਨੂੰ ਪੜ੍ਹਾਉਂਦੇ ਹਨ ਵਧੀਆ ਨਾਲੇਜ ਉਹਨਾਂ ਨੂੰ ਦਿੱਤੀ ਜਾਂਦੀ ਹੈ

ਜਿਹਨਾਂ ਕੋਲ ਪੈਸੇ ਨਹੀਂ ਹੁੰਦੇ ਗਰੀਬ ਲੋਕ ਹੁੰਦੇ ਆ ਅਤੇ ਉਹਨਾਂ ਨੂੰ ਹੈ ਨਾ ਸਹੂਲਤਾਂ ਪ੍ਰਾਪਤ ਕੀਤੀਆਂ ਸ ਸਰਕਾਰੀ ਹਸਪਤਾਲਾਂ 'ਚ ਪੰਜ ਲੱਖ ਦਾ ਫਰੀ ਇਲਾਜ ਕਰਨ ਦੀ ਉਹਨਾਂ ਨੇ ਸਰਕਾਰ ਨੇ ਪੂਰੀ ਉਹ ਦਿੱਤੀ ਆ ਸਹੂਲਤ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਸਰਕਾਰ ਨੇ ਆਪਣੇ ਕ ਪੂਰੇ ਪੰਜਾਬ 'ਚ ਡਵੈਲਪ ਕੀਤੀਆਂ ਨੇ